ਪੰਜਾਬੀ ਪਰਿਵਾਰ ਦੇ ਬੱਚੇ ਜਨਮ ਨੂੰ ਕੇਕ ਕੱਟ ਕੇ ਮਨਾਉਂਦੇ ਨੇ ਅੱਜ ਕੱਲ ਸਭ ਤੋਂ ਪਹਿਲਾਂ ਜਿੰਨੀ ਵੀ ਜਿਹੜੀ ਵੀ ਨੇੜੇ ਤੇੜੇ ਨੈਸ਼ਨਲ ਬੇਕਰੀ ਹੁੰਦੀ ਹੈ ਉਸ ਤੋਂ ਕੇਕ ਲਿਆਂਦਾ ਜਾਂਦਾ ਹੈ ਕੇਕ ਨੂੰ ਕੱਟਦੇ ਹੈ ਨਾਲ ਕੋਈ ਵੀ ਸਮੋਸੇ ਬਰੈੱਡ ਉਹ ਲੈ ਕੇ ਆਉਂਦੇ ਜਾਂਦੇ ਹੈ ਜਿਹੜੇ ਵੀ ਬੱਚੇ ਦਾ ਬਰਡੇ ਹੁੰਦਾ ਹੈ ਉਹ ਆਪਣੇ ਫਰੈਂਡਸ ਨੂੰ ਬੁਲਾਉਂਦਾ ਹੈ ਅਤੇ ਉਹਦਾ ਕੇਕ ਕੱਟਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਕੇਕ ਕੱਟ ਕੇ ਉਹਨੂੰ ਕੀ ਹੈ ਬਰੈੱਡ ਜਾਂ ਸਮੋਸਾ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਸਾਰਿਆਂ ਨੂੰ ਕੋਲਡ ਡ੍ਰਿੰਕ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਓਪਨ ਗਾਣੇ ਚਲਾਏ ਜਾਂਦੇ ਹੈ ਅਤੇ ਸਾਰੇ ਹੀ ਉਸ 'ਤੇ ਬਹੁਤ ਵਧੀਆ ਫੰਨ ਕਰਦੇ ਹੈ ਅਤੇ ਮਸਤੀ ਕਰਦੇ ਹੈ ਨੱਚਦੇ ਹੈ ਅਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਜਿੰਨੀ ਵੀ ਫੈਮਿਲੀਜ਼ ਉਨ੍ਹਾਂ ਬੱਚਿਆਂ ਦੇ ਨਾਲ ਆਈਆਂ ਹੁੰਦੀਆਂ ਹੈ ਉਹ ਕੀ ਹੈ ਛੋਟੇ ਛੋਟੇ ਗਿਫਟਸ ਲੈ ਕੇ ਆਉਂਦੀਆਂ ਨੇ ਕੋਈ ਵੀ ਗਿਫ਼ਟ ਹੋ ਸਕਦੇ ਹੈ ਬੱਚਿਆਂ ਦੇ ਇੰਟਰਸਟ ਦੇ ਅਕੋਡਿੰਗ ਹੁੰਦੇ ਹੈ ਜਾਂ ਫਿਰ ਕੋਈ ਗਿਫ਼ਟ ਦਿੰਦੇ ਹੈ ਕਿ ਜਿਹੜੇ ਐਜੂਕੇਸ਼ਨ ਨਾਲ ਰਿਲੇਟਡ ਹੁੰਦੇ ਹੈ ਜਿਹੜੇ ਕਿ ਉਨ੍ਹਾਂ ਦੀ ਬਹੁਤ ਹੈਲਪ ਕਰਦੇ ਹੈ ਕਿ ਜਿੱਦਾਂ ਕੋਈ ਪੈਂਨਸਿਲਜ ਦੀ ਡੱਬੀ ਦੇਤੀ ਪੈੱਨ ਦੀ ਦੇਤੀ ਜਿਹੜੀ ਕਿ ਉਹਨਾਂ ਨੂੰ ਮਤਲਬ ਆਪਣੇ ਪਰਸਨਲ ਕੰਮ ਕਰਨ ਲਈ ਵੀ ਉਸਦੇ ਵਿੱਚ ਹੈਲਪ ਕਰਦੇ ਹੈ ਅਤੇ ਬਸ ਅੱਜ ਕੱਲ ਐਦਾਂ ਹੀ ਬੱਚੇ ਦੇ ਪਰਿਵਾਰ ਦੇ ਵਿੱਚ ਜਨਮਦਿਨ ਮਨਾਏ ਜਾਂਦੇ ਹੈ